ਮੈਨੂੰ ਖੇਡਾਂ ਬਹੁਤ ਪਸੰਦ ਹਨ ਜੋ ਮੈਨੂੰ ਖੁਸ਼ੀ ਦਿੰਦੀਆਂ ਹਨ ਮੈਨੂੰ ਹਰੇਕ ਖੇਡ ਬਹੁਤ ਪਿਆਰੀ ਲਗਦੀ ਹੈ ਇਹ ਮੈਨੂੰ ਅੰਦਰੋਂ ਧੁਰ ਤੱਕ ਖੁਸ਼ੀ ਦਿੰਦੀਆਂ ਹਨ ਮੈਂ ਆਪਣੀ ਚੋਐਸ ਨਾਲ਼ ਕਦੇ ਕਬੱਡੀ ਕਦੇ ਫੁੱਟਬਾਲ ਜਾਂ ਹੋਰ ਕੋਈ ਵੀ ਗੇਮ ਹੋਵੇ ਵਾਲੀਬਾਲ ਖੇਡਦੇ ਹਾਂ ਅਸੀਂ ਅੱਜ ਵਾਲੀਬਾਲ ਖੇਡੀ ਉਸ ਵਿੱਚ ਸਾਡੀ ਟੀਮ ਨੇ ਮੁਕਾਬਲੇ ਵਿੱਚ ਦੂਜੀ ਟੀਮ ਨੂੰ ਦੋ ਮੈਚ ਹਰਾ ਦਿੱਤੇ ਇਸ ਕਰਕੇ ਫਿਰ ਅਸੀਂ ਕੋਲਡਰਿੰਕ ਪੀਤੀ ਲਿਆ ਕੇ ਜੋ ਜਿੱਤੇ ਉਹਨਾਂ ਨੂੰ ਕੋਲਡਰਿੰਕ ਪਿਲਾਈ ਗਈ ਹਾਰੀ ਵੀ ਟੀਮ ਹਾਰੀ ਵੀ ਟੀਮ ਨੇ ਲਿਆ ਕੇ ਦਿੱਤੀ ਉਹ ਚੀਜ ਇੱਕ ਅਲੱਗ ਹੀ ਖੁਸ਼ੀ ਪੈਦਾ ਕਰਦੀ ਹੈ ਮਨ ਵਿੱਚ ਜੋ ਕਿ ਮੈਨੂੰ ਬਹੁਤ ਖੇਡਾਂ ਨਾਲ਼ ਮੈਨੂੰ ਬਹੁਤ ਪਿਆਰ ਹੈ ਇਸ ਕਰਕੇ ਮੈਂ ਰੋਜ ਆਪਣੀ ਬਦਲ ਬਦਲ ਕੇ ਖੇਡ ਖੇਡਦਾ ਰਹਿੰਦਾ ਹਾਂ ਕਬੱਡੀ ਕਬੱਡੀ ਵੀ ਮੈਨੂੰ ਬਹੁਤ ਪਿਆਰੀ ਹੈ ਜੋ ਕਿ ਮੈਂ ਰੋਜ ਆਪਣੀ ਰੋਜ ਦੀ ਪ੍ਰੈਕਟਿਸ ਵਿੱਚ ਯੂਜ਼ ਕਰਦਾ ਰਹਿੰਦਾ ਕਬੱਡੀ ਨੂੰ ਉਸ ਤੋਂ ਇਲਾਵਾ ਕਦੇ ਕਦੇ ਫੁੱਟਬਾਲ ਦਾ ਵੀ ਗਰਾਊਂਡ ਵਿੱਚ ਖੇਡ ਲਈ ਦੀ ਜਾ ਕੇ ਗੇਮਾਂ ਇੱਕ ਇਹੋ ਜਿਹੀਆਂ ਜਿਸ ਮਨ ਨੂੰ ਧੁਰ ਤੱਕ ਪੂਰੀ ਖੁਸ਼ੀ ਆਨੰਦ ਦਿੰਦੀਆਂ ਹਨ